ਵਿਕਾਸ ਦੇ ਵਿਕਾਸ ਦੇ ਸੰਦਰਭ ਵਿੱਚ ਮੋਹਾਲੀ ਜ਼ਿਲ੍ਹੇ ਦੇ ਸਾਹਮਣੇ ਮੁੱਖ ਚੁਣੌਤੀਆਂ ਹੈਗੀਆਂ ਆਵਾਜਾਈ ਕਿਉਂਕਿ ਇੱਥੇ ਜ਼ਿਆਦਾਤਰ ਲੋਕ ਆਪਣੀ ਜਿਹੜੀ ਹੈਗੀ ਹੈ ਨੌਕਰੀ ਕਰਨ ਆਉਂਦੇ ਐਂ ਤਾਂ ਕਰਕੇ ਇੱਥੇ ਆਵਾਜਾਈ ਦਾ ਬਹੁਤ ਜ਼ਿਆਦਾ ਖਲਾਰਾ ਪੈ ਜਾਂਦਾ ਹੈ ਜਿਸ ਕਰਕੇ ਆਵਾਜਾਈ ਨੂੰ ਸਾਂਭਣਾ ਜਿਹੜਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇੱਥੇ ਲਾਈਟਾਂ ਵਗੈਰਾ ਦਾ ਪ੍ਰਬੰਧ ਜਿਵੇਂ ਇੱਥੇ ਕਈ ਕੁਝ ਜਗ੍ਹਾ 'ਤੇ ਹੈਗਾ ਕੁਝ ਜਗ੍ਹਾ 'ਤੇ ਨਹੀਂ ਹੈਗਾ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਜਿਹੜੀ ਆਵਾਜਾਈ ਦਾ ਹੈਗਾ ਜਿਹੜਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ ਅਤੇ ਜਗ੍ਹਾ ਜਗ੍ਹਾ 'ਤੇ ਲਾਈਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾਵੇ ਹਸਪਤਾਲਾਂ ਦਾ ਜਿਵੇਂ ਹਾਲਾਤ ਨੇ ਉਹ ਕੁਝ ਜਗ੍ਹਾ 'ਤੇ ਬਹੁਤ ਮਾੜੇ ਨੇ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜੇ ਹਸਪਤਾਲਾਂ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਜਿਹੜੇ ਦੂਰੋਂ ਦੂਰੋਂ ਜਾਂ ਫਿਰ ਨੇੜੇ ਦੂਰੋਂ ਨੇੜਿਓਂ ਮਰੀਜ਼ ਵਗੈਰਾ ਆਉਂਦੇ ਨੇ ਉਹਨਾਂ ਨੂੰ ਪ੍ਰੋਪਰ ਉੱਥੇ ਸਹੂਲੀਅਤ ਮਿਲ ਸਕੇ ਅਤੇ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇ ਅਤੇ ਇੱਥੇ ਜਦ ਜਿਵੇਂ ਬਹੁਤ ਜ਼ਿਆਦਾ ਆਬਾਦੀ ਹੋਣ ਕਰਕੇ ਬਹੁਤ ਆਸੇ ਪਾਸੇ ਮਕਾਨਾਂ ਦੀ ਉਸਾਰੀ ਹੋ ਜਾਂਦੀ ਹੈ ਰੁੱਖ ਵਗੈਰਾ ਕੱਟਣੇ ਪੈਂਦੇ ਐਂ ਅਤੇ ਰੁੱਖ ਲਗਾਉਣ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਅਤੇ ਅਪੀਲ ਕਰਨੀ ਚਾਹੀਦੀ ਹੈ ਲੋਕਾਂ ਨੂੰ ਵੀ ਆਸੇ ਪਾਸੇ ਆਪਣੇ ਜਿਹੜੇ ਏ ਵਾਤਾਵਰਨ ਨੂੰ ਸਾਫ਼ ਸੁਥਰਾ ਰੱ ਰੱਖਣ ਲਈ ਰੁੱਖ ਲਗਾਉ ਰੁੱਖ ਲਗਾਏ ਜਾਣ